ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਸਰ ਬਠਿੰਡੇ ਮੇਂ ਕਾਫੀ ਜਗ੍ਹਾ ਨੇ ਘੁੰਮਣ ਲਈ ਤਾਂ ਜਿਵੇਂ ਕਿ ਸਭ ਤੋਂ ਵੱਡੀ ਜਗ੍ਹਾ ਤਾਂ ਇੱਥੇ ਕਿਲ੍ਹਾ ਮੁਬਾਰਕ ਆ ਬਠਿੰਡੇ 'ਚ ਜਿਹਦੇ ਵਿੱਚ ਬਹੁਤ ਵੱਡਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਅਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਉੱਥੇ ਬਹੁਤ ਸਾਰੀਆਂ ਪੁਰਾਣੀਆਂ ਜਗ੍ਹਾ ਬਣੀਆਂ ਹੋਈਆਂ ਜਿੱਥੇ ਕਿ ਰਜੀਆ ਸੁਲਤਾਨ ਨੂੰ ਵੀ ਕੈਦ ਕਰਕੇ ਰੱਖਿਆ ਗਿਆ ਅਤੇ ਇਹ ਹੋਰ ਉੱਥੇ ਜਿਹੜੀਆਂ ਪੁਰਾਣੀਆਂ ਸਿੱਖ ਇਤਿਹਾਸ ਲੜਾਈਆਂ ਵੇਲੇ ਕੋਈ ਤੋਪਾਂ ਸੀ ਕੋਈ ਆਪਣੇ ਇਤਿਹਾਸਿਕ ਜਿਹੜੇ ਹਥਿਆਰ ਸੀ ਉਹ ਵੀ ਉੱਥੇ ਵੀ ਉਹਨਾਂ ਨੇ ਆਰੀਟੋਰੀਏ ਦੇ ਵਿੱਚ ਲਾਏ ਹੋਏ ਆ ਵੀ ਉਹ ਦੇਖਣ ਲਈ ਇੱਕ ਚੰਗੀ ਜਗ੍ਹਾ ਸਿੱਖਾਂ ਦੀ ਦੇਖਣ ਲਈ ਉਸ ਤੋਂ ਬਾਅਦ ਇੱਕ ਹਾਂਜੀ ਉੱਥੇ ਸਰ ਤੁਸੀਂ ਬਠਿੰਡੇ ਬੱਸ ਸਟੈਂਡ ਦੇ ਵਿੱਚ ਉਤਰੋਗੇ ਨਾ ਉੱਥੇ ਤੁਹਾਨੂੰ ਆਟੋ ਮਿਲ ਜੇਗਾ ਉਹ ਦਸ ਵੀਹ ਰੁਪਏ ਲਏਗਾ ਨਹੀਂ ਤਾਂ ਤੁਸੀਂ ਬਾਜ਼ਾਰ ਵਿੱਚ ਦੀ ਗਲੀਆਂ ਵਿੱਚ ਦੀ ਕਿਸੇ ਨੂੰ ਵੀ ਪੁੱਛ ਕੇ ਕਿਲ੍ਹਾ ਮੁਬਾਰਕ ਤਾਂ ਉੱਥੇ ਜਾ ਸਕਦੇ ਹੋ ਹਾਂਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਜੇ ਤੁਸੀਂ ਕੋਈ ਮਤਲਬ ਕਿ ਜਿਵੇਂ ਹੁਣ ਗਰਮੀ ਦਾ ਟਾਈਮ ਆ ਨਾ ਗਰਮੀ ਦਾ ਸੀਜ਼ਨ ਆ ਜਿਵੇਂ ਕਿ ਤੁਸੀਂ ਬੀਚ ਵਗੈਰਾ 'ਤੇ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਉੱਥੇ ਇੱਧਰ ਝੀਲਾਂ ਨੇ ਥਰਮਲ ਪਲਾਂਟ ਨੇ ਬਠਿੰਡੇ ਥਰਮਲ ਪਲਾਂਟ 'ਤੇ ਵਾਲੀ ਸਾਈਡ ਝੀਲਾਂ ਨੇ ਉੱਥੇ ਸ਼ਾਮ ਦੇ ਟਾਈਮ ਬੋਟਿੰਗ ਵਗੈਰਾ ਕਾਫੀ ਘੱਟ ਪੈਸਿਆ 'ਤੇ ਹੋ ਜਾਂਦੀ ਆ ਗੁਨੇਆਣਾ ਰੋਡ ਸਾਈਡ 'ਤੇ ਹਾਂਜੀ ਉੱਥੇ ਸਰ ਹਾਂਜੀ ਹਾਂਜੀ ਉੱਥੇ ਤੁਸੀਂ ਬਸ ਸਰਵਿਸ ਵੀ ਹੈਗੀ ਹੈ ਦਸ ਵੀਹ ਰੁਪਏ ਲੱਗਦੇ ਨੇ ਉੱਥੇ ਵੀ ਤੁਹਾਡੇ ਮੇਨ ਬਸ ਸਟੈਂਡ ਤੋਂ ਅਤੇ ਉੱਥੇ ਤੁਸੀਂ ਆਰਾਮ ਨਾਲ ਜਾ ਸਕਦੇ ਹੋ ਦਸ ਵੀਹ ਰੁਪਏ ਦੇ ਵਿੱਚ ਕੋਈ ਆਪਣਾ ਆਟੋ ਵਗੈਰਾ ਕਰਵਾ ਕੇ ਵੀ ਜਾ ਸਕਦੇ ਹੋ ਆਪਣੇ ਵਹੀਕਲ 'ਤੇ ਵੀ ਜਾ ਸਕਦੇ ਹੋ ਤੁਸੀਂ ਹਾਂਜੀ ਅਤੇ ਉਹਦੇ ਨਾਲ ਹੀ ਅਗਰ ਤੁਸੀਂ ਘੁੰਮ ਫਿਰ ਕੇ ਆਰਾਮ ਕਰਨਾ ਹੋਇਆ ਉਹਦੇ ਨਾਲ ਹੀ ਤੁਹਾਨੂੰ ਰੋਜ਼ ਗਾਰਡਨ ਪਾਰਕ ਆ ਉੱਥੇ ਤੁਸੀਂ ਬੈਠ ਸਕਦੇ ਹੋ ਆਪਣਾ ਖਾਣਾ ਪੀਣਾ ਖਾ ਸਕਦੇ ਹੋ ਉੱਥੇ ਬੈਠ ਕੇ ਆਰਾਮ ਕਰ ਸਕਦੇ ਹੋ ਹਾਂਜੀ ਉਹਦੇ ਨਾਲ ਹੀ ਰੋ ਰੋਜ਼ ਗਾਰਡਨ ਆ ਇਹ ਝੀਲਾਂ ਵਾਲੀ ਸਾਈ ਮਲੋ ਝੀਲਾਂ ਹੈਗੀਆਂ ਗੋਨਿਆਣਾ ਰੋਡ 'ਤੇ ਗੋਨਿਆਣਾ ਤੋਂ ਖੱਬੇ ਹੱਥ ਇਹ ਰੋਕ ਗਾਰਡਨ ਰਹਿ ਜਾਂਦਾ ਜੀ ਬਠਿੰਡੇ ਦੇ ਵਿੱਚ ਰੋਜ਼ ਗਾਰਡਨ ਜਿਹਦੇ ਵਿੱਚ ਤੁਹਾਨੂੰ ਹਰ ਤਰ੍ਹਾਂ ਦੇ ਰੋਜ਼ ਮਿਲਣਗੇ ਉਹ ਵੀ ਬਹੁਤ ਖੂਬਸੂਰਤ ਬਣਿਆ ਹੋਇਆ ਵੀ ਨੈਚੁਰਲ ਪਲੇਸ ਬਣੀ ਹੋਈ ਹੈ ਇੱਕ ਕੁਦਰਤੀ ਪਲੇਸ